ਪੰਜਾਬੀ ਭਾਸ਼ਾ ਦੀਆਂ ਕਈ ਵਿਲੱਖਣ ਵਿਸ਼ੇਸ਼ਤਾਵਾਂ ਹਨ ਜੋ ਇਸ ਨੂੰ ਦੂਜੀਆਂ ਭਾਸ਼ਾਵਾਂ ਤੋਂ ਵੱਖਰਾ ਬਣਾਉਂਦੀਆਂ ਹਨ ਇੱਥੇ ਕੁਝ ਵਿਸ਼ੇਸ਼ਤਾਵਾਂ ਹਨ ਜੋ ਮੈਨੂੰ ਦਿਲਚਸਪ ਲੱਗਦੀਆਂ ਹਨ ਧੁਨੀਆਂ ਦੀ ਭਿੰਨਤਾ ਪੰਜਾਬੀ ਵਿੱਚ ਧੁਨੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ ਜਿਸ ਵਿੱਚ ਕਈ ਅਜਿਹੀਆਂ ਧੁਨੀਆਂ ਸ਼ਾਮਿਲ ਹਨ ਜੋ ਹੋਰ ਭਾਸ਼ਾਵਾਂ ਵਿੱਚ ਨਹੀਂ ਮਿਲਦੀਆਂ ਇਹ ਧੁਨੀਆਂ ਪੰਜਾਬੀ ਨੂੰ ਇੱਕ ਬਹੁਤ ਮਿੱਠੀ ਅਤੇ ਸੰਗੀਤਕ ਭਾਸ਼ਾ ਬਣਾਉਂਦੀਆਂ ਹਨ ਸ਼ਬਦਾਂ ਦਾ ਗਠਨ ਪੰਜਾਬੀ ਵਿੱਚ ਸ਼ਬਦਾਂ ਦਾ ਗਠਨ ਕਰਨ ਦੇ ਬਹੁਤ ਸਾਰੇ ਤਰੀਕੇ ਹਨ ਇਸ ਵਿੱਚ ਉਪਸਾਰਕ ਉਪਸਾਰਕ ਅਤੇ ਸੰਯੁਕਤ ਸ਼ਬਦ ਸ਼ਾਮਿਲ ਹੁੰਦੇ ਹਨ ਇਹ ਸ਼ਬਦ ਗਠਨ ਦੀ ਭਿੰਨਤਾ ਪੰਜਾਬੀ ਨੂੰ ਇੱਕ ਬਹੁਤ ਹੀ ਲੱਖਦਾਰ ਭਾਸ਼ਾ ਬਣਾਉਂਦੇ ਹਨ ਲਿੰਗ ਪੰਜਾਬੀ ਵਿੱਚ ਲਿੰਗ ਦੀ ਸੰਕਲਪਨਾ ਹੋਰ ਭਾਸ਼ਾਵਾਂ ਦੇ ਮੁਕਾਬਲੇ ਕੁਝ ਵੱਖਰੀ ਹੈ ਕਰਮਧਾਰੇ ਪੰਜਾਬੀ ਵਿੱਚ ਕਰਮਧਾਰੇ ਬਹੁਤ ਆਮ ਹਨ ਕਰਮਧਾਰੇ ਉਹ ਸ਼ਬਦ ਹੁੰਦੇ ਹਨ ਜੋ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਬਣਾਏ ਜਾਂਦੇ ਹਨ ਉਦਾਹਰਣ ਲਈ ਮਿੱਠਾ ਪਾਣੀ ਰੋਟੀ ਰਾਟੀ ਲੋਕ ਬੋਲੀਆਂ ਪੰਜਾਬੀ ਵਿੱਚ ਬਹੁਤ ਸਾਰੀਆਂ ਲੋਕ ਬੋਲੀਆਂ ਹਨ ਜਿਵੇਂ ਕਿ ਮਾਝਾ ਮਲਵਈ ਅਤੇ ਦੁਆਬਾ ਇਹ ਲੋਕ ਬੋਲੀਆਂ ਪੰਜਾਬੀ ਭਾਸ਼ਾ ਦੀ ਸਮਰਿਧੀ ਨੂੰ ਦਰਸਾਉਂਦੇ ਹਨ ਕਵਿਤਾਵਾਂ ਅਤੇ ਸੰਗੀਤ ਪੰਜਾਬੀ ਕਵਿਤਾਵਾਂ ਅਤੇ ਸੰਗੀਤ ਲਈ ਮਸ਼ਹੂਰ ਹੈ ਪੰਜਾਬੀ ਕਵਿਤਾਵਾਂ ਨੇ ਪੰਜਾਬੀ ਭਾਸ਼ਾ ਨੂੰ ਇੱਕ ਨਵੀਂ ਉਚਾਈ ਦਿੱਤੀ ਹੈ